ਪਿੰਡਾਂ ਅਤੇ ਸ਼ਹਿਰਾਂ ਦੇ ਰਹਿਣ ਸਹਿਣ ਦੋਨੋਂ ਵੱਖਰੇ ਹਨ ਅਤੇ ਐਥੇ ਵੈਸੇ ਤਾਂ ਅਲੱਗ ਅਲੱਗ ਬਿਮਾਰੀਆਂ ਦੇ ਫੈਲਦੀਆਂ ਹਨ ਪਰ ਕੁਛ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਕਿ ਸਵਾਇਨ ਫਲੂ ਆਈ ਫਲੂ ਇਹ ਹਰ ਇੱਕ ਖੇਤਰ ਵਿੱਚ ਪੇਂਡੂ ਅਤੇ ਸ਼ਹਿਰਾਂ ਵਿੱਚ ਦੋਨਾਂ 'ਤੇ ਹੀ ਪ੍ਰਭਾਵ ਪਾਉਂਦੀਆਂ ਹਨ ਪਰ ਇਸ ਨੂੰ ਸਮੇਂ ਦੌਰਾਨ ਸਾਵਧਾਨੀਆਂ ਵਰਤ ਕੇ ਅਤੇ ਡੋਕਟਰ ਦੀ ਸਹਾਇਤਾ ਨਾਲ ਅਤੇ ਸੁਝਾਅ ਨਾਲ ਇਸ ਨੂੰ ਸੰਭਾਲਣਾ ਚਾਹੀਦਾ ਹੈ ਅਤੇ ਇਸ ਨੂੰ ਕੰਟਰੋਲ ਵਿੱਚ ਰੱਖਣਾ ਚਾਹੀਦਾ ਹੈ ਕਿਉਂਕਿ ਇਹ ਇੱਕ ਦੂਜੇ ਤੋਂ ਫੈਲਦੀ ਹੈ ਅਤੇ ਇਸ ਤੋਂ ਬਿਨਾਂ ਇਸ ਤੋਂ ਬਿਨਾਂ ਜਿਵੇਂ ਕਿ ਕਰੋਨਾ ਦੀ ਬਿਮਾਰੀ ਫੈਲੀ ਸੀ ਉਹ ਇੱਕ ਬਹੁਤ ਹੀ ਜ਼ਿਆਦਾ ਖ਼ਤਰਨਾਕ ਸੀ ਉਸ ਨੇ ਪਿੰਡਾਂ ਅਤੇ ਸ਼ਹਿਰਾਂ ਦੋਨਾਂ 'ਤੇ ਹੀ ਹਮਲਾ ਕੀਤਾ ਹੈ ਇਸ ਤੋਂ ਬਿਨਾਂ ਉਸ ਨੂੰ ਇੰਜੈਕਸ਼ਨ ਦੁਆਰਾ ਸਰਕਾਰ ਦੀ ਹਦਾਇਤ ਦੁਆਰਾ ਹਰ ਇੱਕ ਨੇ ਕੰਟਰੋਲ ਵਿੱਚ ਅਤੇ ਆਪਣੇ ਆਪ ਨੂੰ ਸੰਭਾਲਿਆ ਹੈ ਅਤੇ ਇਸ ਤੋਂ ਬਿਨਾਂ ਪਿੰਡਾਂ ਦੇ ਵਿੱਚ ਆਮ ਤੌਰ 'ਤੇ ਸ਼ਹਿਰਾਂ ਨਾਲੋਂ ਬਿਮਾਰੀਆਂ ਘੱਟ ਹੁੰਦੀਆਂ ਹਨ ਕਿਉਂਕਿ ਸ਼ਹਿਰਾਂ ਵਿੱਚ ਪ੍ਰਦੂਸ਼ਣ ਦੀ ਜ਼ਿਆਦਾ ਵੱਧਤਾ ਹੁੰਦੀ ਹੈ ਅਤੇ ਪਿੰਡਾਂ ਵਿੱਚ ਖੁੱਲੀ ਹਵਾ ਅਤੇ ਸਾਫ਼ ਸੁਥਰਾ ਵਾਤਾਵਰਨ ਅਤੇ ਖਾਣ ਪੀਣ ਹੁੰਦਾ ਹੈ ਜਿਸ ਕਰਕੇ ਪਿੰਡਾਂ ਦੇ ਲੋਕ ਸ਼ਹਿਰਾਂ ਨਾਲੋਂ ਘੱਟ ਬਿਮਾਰ ਹੁੰਦੇ ਹਨ ਅਤੇ ਸਿਹਤਮੰਦ ਰਹਿੰਦੇ ਹਨ